ਜੀ ਹਾਂ ਮੈਂ ਇਹਦਾ ਵਰਣਨ ਕਰ ਸਕਦਾ ਹਾਂ ਜਦੋਂ ਮੈਂ ਕੁਝ ਸਮੇਂ ਪਹਿਲਾਂ ਕਾਲਜ ਪੜ੍ਹਦਾ ਹੁੰਦਾ ਸੀ ਉਹਦੇ ਵਿੱਚ ਇੱਕ ਇੰਟਰੋਡਕਸ਼ਨ ਪ੍ਰੋਗਰਾਮ ਸੀ ਅਤੇ ਇੰਟਰੋਡਕਸ਼ਨ ਦੇ ਅੰਦਰ ਓਰੀਐਨਟੇਸ਼ਨ ਪ੍ਰੋਗਰਾਮ ਸੀਗਾ ਜਿਹਦੇ ਵਿੱਚ ਉਹਨਾਂ ਨੇ ਇੱਕ ਯਾਤਰੀ ਬੱਸ ਨੂੰ ਬੁੱਕ ਕੀਤਾ ਸੀਗਾ ਸਾਡੇ ਕੋਲਜ ਵਾਲਿਆਂ ਨੇ ਉਹਦੇ ਵਿੱਚ ਫਿਰ ਅਸੀਂ ਯਾਤਰੀ ਬੱਸ ਵਿੱਚ ਬੈਠੇ ਫਿਰ ਸਾਨੂੰ ਪਤਾ ਲੱਗਾ ਕਿ ਉਹਦੇ ਵਿੱਚ ਇੱਕ ਸੀਟ ਹੁੰਦੀ ਆ ਠੀਕ ਆ ਅਸੀਂ ਸੀਟਾਂ ਵਿੱਚ ਬਹਿ ਗਏ ਵਿੰਡੋ ਸੀਟਾਂ ਵਿੱਚ ਬਹਿ ਗਏ ਵਿੰਡੋ ਸੀਟਾਂ ਦਾ ਵੱਖਰਾ ਨਜ਼ਾਰਾ ਹੁੰਦਾ ਈ ਕਿਉਂਕਿ ਅਸੀਂ ਸਭ ਕੁਛ ਦੇਖ ਸਕਦੇ ਹੀ ਅਸੀਂ ਬੱਸਾਂ ਵਿੱਚ ਜਾਂਦੇ ਸੀਗੇ ਉਹਦੇ ਪਾਸ ਉਹਦੇ ਉੱਪਰ ਵੀ ਆਪਾਂ ਬਹਿ ਸਕਦੇ ਸੀ ਇਹ ਮੈਨੂੰ ਪਹਿਲੀ ਵਾਰੀ ਪਤਾ ਲੱਗਾ ਕਿ ਬੱਸ ਦੇ ਉੱਤੇ ਵੀ ਅਸੀਂ ਬਹਿ ਸਕਦੇ ਹੈਗੇ ਆ ਉਹਦੇ ਵਿੱਚ ਆਪਾਂ ਸਮਾਨ ਰੱਖ ਸਕਦੇ ਹਾਂ ਕਿਉਂਕਿ ਥੱਲੇ ਜਗ੍ਹਾ ਘੱਟ ਪੈ ਜਾਂਦੀ ਆ ਉਸ ਤੋਂ ਬਾਅਦ ਫਿਰ ਉੱਥੇ ਕੈਬਿਨ ਹੁੰਦਾ ਆ ਡਰਾਈਵਰ ਦੀ ਸੀਟ ਹੁੰਦੀ ਆ ਬੱਸਾਂ ਦੇ ਵਿੱਚ ਜਿਹਦੇ ਵਿੱਚ ਡਰਾਈਵਰ ਆਪਣਾ ਸਭ ਕੁਛ ਕਰਦਾ ਆਪਣੇ ਹੈਂਡਲ ਉਹਦੇ ਕੋਲ ਸਾਰੇ ਕੰਟਰੋਲਸ ਹੁੰਦੇ ਹੈਗੇ ਬਸ ਦੇ ਉਸ ਡਰਾਈਵਰ ਸੀਟ 'ਤੇ ਕੈਬਿਨ ਵਿੱਚ ਜਿਹੜਾ ਹੈਗਾ ਕੰਡਕਟਰ ਬਹਿੰਦਾ ਹੁੰਦਾ ਆ ਉਹ ਸਾਰਾ ਮੈਨੂੰ ਦੱਸਦਾ ਆ ਕਿ ਅਸੀਂ ਕਿਹੜੇ ਸਟੇਸ਼ਨ 'ਤੇ ਹੈਗੇ ਹੈ ਅਤੇ ਕਿਹੜਾ ਸਟੇਸ਼ਨ ਆਉਣ ਵਾਲਾ ਆ ਅਤੇ ਜੇ ਸਾਡੀ ਕੋਈ ਆਪਣੀ ਪਰਸਨਲ ਰਿਕੁਐਸਟ ਹੁੰਦੀ ਸੀਗੀ ਅਤੇ ਆਪਾਂ ਨੂੰ ਕੁਛ ਉਹਨਾਂ ਨੂੰ ਦੱਸਣਾ ਹੋਵੇ ਵੱਖਰੇ ਜਾ ਕੇ ਤਾਂ ਉਹਨਾਂ ਨੂੰ ਬੋਲ ਸਕਦੇ ਸੀ ਉਹ ਸਾਡੀ ਗੱਲ ਮੰਨ ਲੈਂਦਾ ਹੁੰਦੇ ਸੀਗਾ ਕਿਉਂਕਿ ਅਤੇ ਇੰਡਕਸ਼ਨ ਵਿੱਚ ਅਸੀਂ ਜਦੋਂ ਘੁੰਮਣ ਗਏ ਸੀਗੇ ਅਸੀਂ ਗਏ ਸੀਗੇ ਖਟਕੜ ਕਲਾਂ ਗਏ ਸੀਗੇ ਅਸੀਂ ਸ਼ਹੀਦ ਭਗਤ ਸਿੰਘ ਜੀ ਦੇ ਘਰ ਨੂੰ ਗਏ ਸੀ ਘੁੰਮਣ ਲਈ ਅਸੀਂ ਉੱਥੇ ਬਹੁਤ ਇੰਜੋਏ ਕੀਤਾ ਅਸੀਂ ਬਹੁਤ ਕੁਝ ਦੇਖਿਆ ਉੱਥੇ ਅਰ ਬਹੁਤ ਕੁਛ ਸਿੱਖਣ ਨੂੰ ਮਿਲਿਆ ਅਤੇ ਆਪਣੀ ਬੱਸਾਂ ਵਿੱਚ ਅਸੀਂ ਜਦੋਂ ਜਾ ਰਹੇ ਸੀਗੇ ਉਹਦੇ ਵਿੱਚ ਸਾਊਂਡ ਸਿਸਟਮ ਸੀ ਜੋ ਕਿ ਬਹੁਤ ਹੀ ਵਧੀਆ ਕੁਆਲਟੀ ਦੇ ਹੁੰਦੇ ਆ ਅਸੀਂ ਸਾਰਾ ਰਸਤੇ ਖੁਸ਼ੀ ਨਾਲ ਗਏ ਅਸੀਂ ਹੱਸਦੇ ਨੱਚਦੇ ਗਏ ਪੂਰੇ ਬੱਸ ਵਿੱਚ ਸਾਰੇ ਜਿਹੜੇ ਸੀਗੇ ਸਾਨੂੰ ਵੇਖਦੇ ਪਏ ਸੀਗੇ ਅਸੀਂ ਬਹੁਤ ਹੀ ਖੁਸ਼ ਸੀਗੇ ਕਿਉਂਕਿ ਸਾਡਾ ਇਹ ਪਹਿਲਾ ਟਰਿੱਪ ਸੀਗਾ ਜਿਹੜਾ ਅਸੀਂ ਕੋਲਜ ਤੋਂ ਜਾ ਰਹੇ ਸੀ ਅਤੇ ਇਹਦੇ ਵਿੱਚ ਬਹੁਤ ਹੀ ਮਜ਼ਾ ਆ ਰਿਹਾ ਸੀਗਾ ਇੱਦਾਂ ਕਰਦੇ ਕਰਦੇ ਅਸੀਂ ਉੱਥੇ ਪਹੁੰਚੇ ਅਸੀਂ ਉੱਥੇ ਬਹੁਤ ਹੀ ਕੁਛ ਇੰਜੋਏ ਕੀਤਾ ਉਸ ਤੋਂ ਬਾਅਦ ਸਾਨੂੰ ਬੱਸ ਵਿੱਚ ਰੀਫਰੈਸ਼ਮੈਂਟ ਵੀ ਮਿਲਦੀ ਰਹੀ ਲਾਇਕ ਹ ਕੋਈ ਨਾ ਕੋਈ ਆ ਹੀ ਜਾਂਦਾ ਸੀ ਬੱਸ 'ਚ ਬਹਿ ਕੇ ਆਪਣਾ ਸਮਾਨ ਵੇਚਣ ਲਈ ਸਾਨੂੰ ਕਿੱਥੇ ਜਾਣਾ ਨਹੀਂ ਪੈਂਦਾ ਸੀਗਾ ਸਮਾਨ ਲੈਣ ਦੇ ਲਈ ਅਸੀਂ ਜਦੋਂ ਸਾਨੂੰ ਥੋੜ੍ਹੀ ਜਿਹੀ ਭੁੱਖ ਲੱਗਦੀ ਅਸੀਂ ਬੱਸ ਡਰਾਈਵਰ ਨੂੰ ਬੋਲ ਦਿੰਦੇ ਹੁੰਦੇ ਕਿਉਂਕਿ ਸਾਡੀ ਆਪਣੀਆਂ ਬੁੱਕ ਕਰਵਾਈ ਸੀ ਅਸੀਂ ਬੱਸ ਅਸੀਂ ਉਹਨੂੰ ਬੋਲ ਕੇ ਰੁਕਵਾ ਲੈਂਦੇ ਸੀਗੇ ਆਪਾਂ ਆਪਣੇ ਸਰ ਨੂੰ ਬੋਲਦੇ ਸੀ ਉਹ ਅੱਗੇ ਬੱਸ ਡਰਾਈਵਰ ਨੂੰ ਬੋਲ ਦਿੰਦਾ ਸੀਗਾ ਕਿ ਉਹ ਬੱਸ ਰੁਕਵਾ ਦੇਵੇ ਅਸੀਂ ਜਾ ਕੇ ਉੱਥੇ ਖਾਣਾ ਖਾ ਲਈਦਾ ਹੁੰਦਾ ਸੀਗਾ ਅਤੇ ਅਸੀਂ ਘੁੰਮਦੇ ਘੁੰਮਦੇ ਵਾਪਿਸ ਆ ਰਹੇ ਸੀ ਸਾਡਾ ਹਵੇਲੀ 'ਚ ਗਏ ਸੀ ਆਪਾਂ ਸਾਡੇ ਪਿੰਡ ਗਏ ਸੀਗੇ ਹਵੇਲੀ ਗਏ ਸੀਗੇ ਉੱਥੇ ਵੀ ਅਸੀਂ ਬਹੁਤ ਮਸਤੀ ਕੀਤੀ ਇਹ ਸਾਰਾ ਉਸ ਬੱਸ ਦੇ ਕਰਕੇ ਹੋਇਆ ਹੈ ਅਤੇ ਇਸਦਾ ਮੇਰੇ ਬੱਸ ਵੱਲ ਮੇਰਾ ਧਿਆਨ ਵਧਿਆ ਅਤੇ ਮੈਂ ਹੋਰ ਬੱਸਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਫਿਰ ਇੱਦਾਂ ਹੀ ਬੱਸਾਂ ਵੱਲ ਜਾਂਦੇ ਜਾਂਦੇ ਨਾ ਮੈਨੂੰ ਪਤਾ ਲੱਗਾ ਕਿ ਅਸੀਂ ਬੱਸਾਂ ਵੱਲ ਜਾਂਦੇ ਹਾਂ ਅਸੀਂ ਉਹਨਾਂ ਨੂੰ ਪੈਸੇ ਦਿੰਦੇ ਹਾਂ ਅਤੇ ਉਹ ਸਾਨੂੰ ਸਾਡੀ ਜਗ੍ਹਾ 'ਤੇ ਛੱਡ ਦਿੰਦੇ ਆ ਅਤੇ ਫਿਰ ਇਹਦੇ ਵਿੱਚ ਸਰਕਾਰ ਨੇ ਵੀ ਬਹੁਤ ਮਦਦ ਕੀਤੀ ਕਿਉਂਕਿ ਜਿਹੜੀ ਬੀਬੀਆਂ ਹੁੰਦੀਆਂ ਸੀਗੀਆਂ ਉਹ ਬੱਸਾਂ ਵਿੱਚ ਟਰੈਵਲ ਬਹੁਤ ਘੱਟ ਕਰਦੀਆਂ ਸੀ ਤਾਂ ਉਹਨਾਂ ਨੇ ਉਹਨਾਂ ਦਾ ਆਧਾਰ ਕਾਰਡ ਇਸਤੇਮਾਲ ਕਰਤਾ ਅਤੇ ਬੱਸਾਂ ਲਈ ਉਹਨਾਂ ਨੂੰ ਫਰੀ ਕਰ ਤਾ ਹੁਣ ਬੀਬੀਆਂ ਆਪਣਾ ਆਧਾਰ ਕਾਰਡ ਦੇ ਕੇ ਸਰਕਾਰੀ ਬੱਸਾਂ 'ਚ ਫਰੀ ਬਹਿੰਦੀਆਂ ਸੀਗੀਆਂ ਉਹ ਜਿੱਥੇ ਜਾਣਾ ਸੀ ਉਹ ਜਾਂਦੀਆਂ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈਗਾ ਉਹ ਬਿਨਾਂ ਪੈਸੇ ਖਰਚ ਕੀਤੇ ਜਿੱਥੇ ਮਰਜੀ ਜਾ ਸਕਦੀਆਂ ਹੈਗੀਆਂ ਧੰਨਵਾਦ